ਹਾਂਜੀ ਭਾਅ ਜੀ ਸਤਿ ਸ਼੍ਰੀ ਅਕਾਲ ਜੀ ਸੁਖਪਾਲ ਭਾਅ ਜੀ ਬੋਲਦੇ ਜੀ ਹਾਂਜੀ ਭਾਅ ਜੀ ਮੈਂ ਕਪੂਰਥਲੇ ਆਇਆ ਸੀਗਾ ਅਤੇ ਮੈਨੂੰ ਮੇਰੇ ਫਰੈਂਡ ਤੋਂ ਨੰਬਰ ਮਿਲਿਆ ਸੀਗਾ ਵੀ ਮੈਂ ਇੱਥੇ ਘੁੰਮਣਾ ਚਾਹੁੰਦਾ ਹਾਂ ਵੀ ਇੱਥੇ ਦੀਆਂ ਮੈਨੂੰ ਜਿਹੜੇ ਗੁਰਦੁਆਰਾ ਸਾਹਿਬ ਆ ਜਾਂ ਮੰਦਰ ਆ ਮੈਂ ਉੱਥੇ ਜਾ ਕੇ ਵਿਜ਼ਿਟ ਕਰਨਾ ਚਾਹੁੰਦਾ ਨਾਲੇ ਮੈਂ ਘੁੰਮਣਾ ਚਾਹੁੰਦਾ ਸੀਗਾ ਜੀ ਹਾਂਜੀ ਹਾਂਜੀ ਹਾਂਜੀ ਸਰ ਪਰ ਡੇਅ ਜੀ ਪਰ ਡੇਅ ਠੀਕ ਆ ਸਰ ਠੀਕ ਆ ਜੀ ਠੀਕ ਆ ਜੀ ਠੀਕ ਆ ਜੀ ਹਾਂਜੀ ਸਰ ਠੀਕ ਆ ਬ੍ਰੋ ਹਾਂਜੀ ਹਾਂਜੀ ਸਰ ਮੈਂ ਤੁਹਾਡਾ ਔਫਿਸ ਆ ਜਾਂਦਾ ਤੁਸੀਂ ਮੈਨੂੰ ਆਪਣਾ ਔਫਿਸ ਦੀ ਲੋਕੇਸ਼ਨ ਸ਼ੇਅਰ ਕਰ ਦਿਓ ਮੈਂ ਉੱਥੇ ਆ ਕੇ ਤੁਹਾਡੇ ਕੋ ਗੱਲ ਕਰ ਲੈਂਦਾ ਸਰ ਜੀ ਸਰ ਜੀ ਸਰ ਠੀਕ ਆ ਸਰ ਓ ਓਕੇ ਭਾਅ ਜੀ ਓਕੇ ਓਕੇ ਓਕੇ ਥੈਂਕਯੂ ਸੋ ਮਚ